ਮੈਂ ਸੁਨੀਲ ਕੁਮਾਰ ਪਿੰਡ ਮਿਰਜਾਪੁਰ ਜ਼ਿਲ੍ਹਾ ਗੁਰਦਾਸਪੁਰ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਯੋਗਾ ਵਿੱਚ ਕਿਹੜੇ ਆਸਣ ਕੀਤੇ ਜਾਂਦੇ ਹਨ ਨੰਬਰ ਇੱਕ 'ਤੇ ਤੜ ਆਸਣ ਤੜ ਆਸਣ ਮਹੱਤਵਪੂਰਨ ਆਸਣ ਹੈ ਇਸ ਨੂੰ ਕਰਨ ਲਈ ਤੁਹਾਨੂੰ ਖੁੱਲ੍ਹੀ ਜਗ੍ਹਾ ਵਿੱਚ ਖੜ੍ਹਾ ਖੜ੍ਹ ਕੇ ਆਪਣੇ ਪੈਰ ਇੱਕ ਦੂਜੇ ਨਾਲ ਜੋੜ ਕੇ ਖੜ੍ਹਾ ਹੋਣਾ ਹੈ ਫਿਰ ਆਪਣੇ ਦੋਹਾਂ ਹੱਥਾਂ ਨੂੰ ਧੀਰੇ ਨਾਲ ਸਿੱਧਾ ਉੱਪਰ ਲਿਜਾਓ ਅਤੇ ਉਂਗਲਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ ਆਪਣੇ ਸਰੀਰ ਨੂੰ ਉੱਪਰ ਕੀਤੇ ਹੱਥਾਂ ਵੱਲ ਖਿੱਚੋ ਅਤੇ ਪੈਰਾਂ ਦੇ ਅੰਗੂਠਿਆਂ ਨਾਲ ਜ਼ਮੀਨ ਨੂੰ ਪਕੜੋ ਇਸ ਆਸਣ ਇਸ ਆਸਣ ਨਾਲ ਤੁਹਾਡੇ ਰੀੜ੍ਹ ਦੀ ਹੱਡੀ ਮਜ਼ਬੂਤ ਹੁੰਦੀ ਹੈ ਅਤੇ ਪੂਰੇ ਸਰੀਰ ਦੀ ਪੋਚਰਸ ਸਹੀ ਹੁੰਦੀ ਹੈ ਇਹ ਸਰੀਰ ਨੂੰ ਸਥਿਰਤਾ ਅਤੇ ਧਿਆਨ ਕਾਇਮ ਕਰਨ ਲਈ ਮਦਦ ਕਰਦਾ ਹੈ ਫਾਇਦੇ ਤੜ ਆਸਣ ਨਾਲ ਸਰੀਰ ਦੀ ਲੰਬਾਈ ਵੱਧਦੀ ਹੈ ਮਾਸਪੇਸ਼ੀਆਂ ਦੀ ਮਜ਼ਬੂਤੀ ਆਉਂਦੀ ਹੈ ਅਤੇ ਬਲਸ ਵਿੱਚ ਸੁਧਾਰ ਹੁੰਦਾ ਹੈ ਨੰਬਰ ਦੋ ਬ੍ਰਿਕਸ਼ ਆਸਣ ਇਹ ਆਸਣ ਬੈਂਲਸ ਅਤੇ ਫੋਰਸ ਲਈ ਪ੍ਰਸਿੱਧ ਹੈ ਬ੍ਰਿਕਸ਼ ਆਸਣ ਕਰਨ ਲਈ ਪਹਿਲਾਂ ਆਪਣੇ ਪੈਰਾਂ ਨੂੰ ਜੋੜ ਕੇ ਇੱਕ ਪੈਰ ਨਾਲ ਜ਼ਮੀਨ 'ਤੇ ਖੜ੍ਹੋ ਖੜ੍ਹੇ ਹੋ ਜਾਓ ਅਤੇ ਦੂਜੇ ਪੈਰ ਨੂੰ ਆਪਣੇ ਮੋਢੇ ਜਾਂ ਅੰਗੂਠੇ 'ਤੇ ਰੱਖੋ ਫਿਰ ਆਪਣੇ ਹੱਥਾਂ ਨੂੰ ਸਿੱਧਾ ਉੱਪਰ ਚੁੱਕ ਕੇ ਪ੍ਰਸਥਾਪਨਾ ਦੀ ਮੁਦਰਾ ਵਿੱਚ ਜੋੜੋ ਇਹ ਆਸਣ ਸਰੀਰ ਨੂੰ ਬਾਲਸ ਕਰਨ ਲਈ ਬਹੁਤ ਮਹੱਤਵਪੂਰਨ ਹੈ ਅਤੇ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ਧੰਨਵਾਦ ਜੀ